ਸਤਿ ਸ਼੍ਰੀ ਅਕਾਲ ਜੀ ਪਿਛਲੇ ਹਫਤੇ ਮੈਂ ਤੁਹਾਡੇ ਵੈੱਬਸਾਈਡ ਤੋਂ ਬੂਟ ਓਡਰ ਕੀਤੇ ਸਨ ਜੋ ਕਿ ਮੇਰੇ ਕੋਲ ਬਹੁਤ ਲੇਟ ਪਹੁੰਚੇ ਅਤੇ ਉਸ ਦੀ ਪੈਕੇਜਿੰਗ ਅਤੇ ਬੂਟਾਂ ਦੀ ਕੁਆਲਿਟੀ ਬਹੁਤ ਹੀ ਖਰਾਬ ਸੀ ਇਸ ਕਰਕੇ ਮੇਰੇ ਸਾਰੇ ਪੈਸੇ ਖਰਾਬ ਹੋ ਗਏ ਅਤੇ ਮੈਂ ਅੱਗੇ ਤੋਂ ਤੁਹਾਡੇ ਤੋਂ ਕੋਈ ਵੀ ਸ਼ਾਪਿੰਗ ਨਹੀਂ ਕਰਨੀ